ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਪੁਰਾਣੇ ਟਾਈਮ ਦੀ ਪੁਰਾਣੇ ਟਾਈਮ ਦੇ ਵਿੱਚ ਇਹ ਬਹੁਤ ਹੀ ਪ੍ਰਕਾਰ ਦੇ ਨੁਸਖੇ ਹੁੰਦੇ ਸਨ ਜੋ ਕਿ ਕਈ ਨੁਸਖੇ ਅੱਜ ਦੇ ਟਾਈਮ ਵੀ ਵਰਤੇ ਜਾਂਦੇ ਹਨ ਜਿਵੇਂ ਕਿ ਆਪਾਂ ਅੱਜ ਗੱਲ ਕਰਾਂਗੇ ਪਿੱਠ ਦੇ ਦਰਦ ਦੀਠ ਜਿਵੇਂ ਕਿ ਆਪਾਂ ਅੱਜ ਗੱਲ ਕਰਾਂਗੇ ਪਿੱਠ ਦੇ ਦਰਦ ਦੇ ਘਰੇਲੂ ਨੁਸਖੇ ਕਿਵੇਂ ਕਿਵੇਂ ਪਿੱਠ ਦਾ ਦਰਦ ਠੀਕ ਕੀਤਾ ਜਾਂਦਾ ਹੈ ਜਿਹੜਾ ਆਪਾਂ ਸਰ੍ਹੋਂ ਦਾ ਤੇਲ ਸਰ੍ਹੋਂ ਦੇ ਤੇਲ ਨੂੰ ਪਹਿਲਾਂ ਹਲਕਾ ਜਿਹਾ ਕੋਸਾ ਕਰਕੇ ਉਹਦੇ ਵਿੱਚ ਅਜਵਾਇਨ ਮਿਕਸ ਕਰਕੇ ਜਾਂ ਹਲਕਾ ਜਿਹਾ ਸ਼ਹਿਦ ਮਿਕਸ ਕਰਕੇ ਉਹ ਪਿੱਠ ਦੇ ਉੱਪਰ ਅਗਰ ਉਹਦੀ ਮਾਲਿਸ਼ ਕਰਦੇ ਹਾਂ ਤਾਂ ਉਸ ਦੇ ਨਾਲ ਪਿੱਠ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੇ ਅਗਰ ਸੌ ਪਰਸੈਂਟ ਦਰਦ ਹੈ ਤਾਂ ਉਹ ਸੱਤਰ ਪਰਸੈਂਟ ਦਰਦ ਮਾਲਿਸ਼ ਕਰਦੇ ਵਕਤ ਹੀ ਖਤਮ ਹੋ ਜਾਂਦਾ ਜਿਵੇਂ ਆਪਾਂ ਗੱਲ ਕ ਕੀਤੀ ਜਾਵੇ ਦੂਜੇ ਨੁਸਖੇ ਦੀ ਦੂਜਿਆਂ ਨੁਸਕਾ ਇਹ ਹੈ ਕਿ ਆਪਾਂ ਇੱਕ ਪਰਸਨ ਦੂਜੇ ਪਰਸਨ ਨੂੰ ਫੜ ਕੇ ਉਹਦੀ ਪਿੱਠ ਨੂੰ ਐਂ ਚੰਗੀ ਤਰ੍ਹਾਂ ਰੀੜ ਦੀ ਹੱਡੀ ਕੋਲ ਹੱਥ ਕਰਾ ਕੇ ਉਹਦਾ ਪਟਾਕਾ ਵਜਾਉਂਦਾ ਹੈ ਅਤੇ ਉਹ ਉਹਦੇ ਨਾਲ ਪਿੱਠ ਦਾ ਦਰਦ ਇੱਕ ਏ ਦਮ ਸੈਟ ਹੋ ਜਾਂਦਾ ਹੈ ਆਪਾਂ ਤੀਜੇ ਨੁਸਖੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਤੀਜਾ ਨੁਸਖਾ ਬਹੁਤ ਹੀ ਜ਼ਿਆਦਾਤਰ ਘਰਾਂ ਦੇ ਵਿੱਚ ਵਰਤਿਆ ਜਾਂਦਾ ਹੈ ਸਿਰਫ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕੀਤੀ ਜਾਂਦੀ ਹੈ ਉਸ ਦੇ ਪਿੱਠ ਦੇ ਵਿੱਚ ਜਿਸ ਦੀ ਪਿੱਠ 'ਚ ਦਰਦ ਹੁੰਦਾ ਹੈ ਅਤੇ ਆਪਾਂ ਅਗਰ ਗੱਲ ਅਤੇ ਆਪਾਂ ਅਗਰ ਗੱਲ ਕੀਤੀ ਜਾਵੇ ਹੋਰ ਕਈ ਅੱਜ ਵੈਸੇ ਅਗਰ ਆਪਾਂ ਗੱਲ ਕਰਦੇ ਹਾਂ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਤਰ੍ਹਾਂ ਦੀਆਂ ਨੁਸਖੇ ਆ ਗਏ ਹਨ ਵੈਸੇ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਆਪਾਂ ਉਹ ਨੁਸਖਿਆਂ ਨੂੰ ਆਪਾਂ ਬਹੁਤ ਹੀ ਪ੍ਰਕਾਰ ਦੇ ਨਾਲ ਭੁੱਲ ਵੀ ਜਾ ਭੁੱਲਦੇ ਵੀ ਜਾ ਰਹੇ ਹਾਂ ਸਰ੍ਹੋਂ ਦੇ ਤੇਲ ਵਾਲੇ ਨੂੰ ਅਤੇ ਹੌਲੀ ਹੌਲੀ ਜਿਵੇਂ ਜਿਵੇਂ ਟਾਈਮ ਬੀਤਦਾ ਜਾਵੇਗਾ ਕੀ ਪਤਾ ਅਸੀਂ ਉਸ ਨੁਸਖਿਆਂ ਨੂੰ ਸਾਰਿਆਂ ਨੂੰ ਭੁੱਲਣਾ ਚਾਹੀਏ ਤਾਂ ਕਰਕੇ ਤੁਸੀਂ ਜੋ ਵੀ ਅੱਜ ਦੇ ਟਾਈਮ ਵੈਸੇ ਤਾਂ ਬਹੁਤ ਮੈਡੀਸਨ ਆ ਚੁੱਕੀਆਂ ਹਨ ਦਵਾਈਆਂ ਆ ਚੁੱਕੀਆਂ ਜਿਹਦੇ ਨਾਲ ਪਿੱਠ ਦਾ ਦਰਦ ਠੀਕ ਕੀਤਾ ਜਾਂਦਾ ਹੈ ਅਤੇ ਬਾਕੀ ਅੱਗੇ ਅੱਗੇ ਜਿੱਦਾਂ ਜਿੱਦਾਂ ਟਾਈਮ ਬਦਲਦਾ ਜਾਵੇਗਾ ਉਵੇਂ ਉਵੇਂ ਪਤਾ ਲੱਗਦਾ ਜਾਵੇਗਾ ਕਿ ਕੀ ਕੀ ਅੱਗੇ ਅੱਗੇ ਹੋਰ ਆ ਆ ਆਣ ਆਉਣਗੇ ਜਾਂ ਆਊਗੇ